ਸਤਿ ਸ਼੍ਰੀ ਅਕਾਲ ਜੀ ਮੈਂ ਪਿਛਲੇ ਦਿਨੀਂ ਅਸਫਾਈਡ ਕੰਪਨੀ ਦੀ ਇੱਕ ਕੈਬ ਚੰਡੀਗੜ੍ਹ ਤੋਂ ਦਿੱਲੀ ਜਾਣ ਦੇ ਲਈ ਬੁੱਕ ਕੀਤੀ ਸੀ ਇਸ ਕੈਬ ਸੰਬੰਧੀ ਜੋ ਮੇਰੇ ਕੋਲ ਪਹਿਲਾਂ ਜਾਣਕਾਰੀ ਸੀ ਉਹ ਇਹ ਸੀ ਕਿ ਇਹ ਕੈਬ ਬੜੀ ਸਾਫ ਸੁਥਰੀ ਹੁੰਦੀ ਹੈ ਅਤੇ ਸਮੇਂ ਸਿਰ ਪਹੁੰਚਾਉਂਦੀ ਹੈ ਪਰੰਤੂ ਮੈਂ ਤੁਹਾਡੇ ਕੋਲ ਇਹ ਸ਼ਿਕਾਇਤ ਦਰਜ ਕਰਵਾਉਣੀ ਚਾਹੁੰਦਾ ਹਾਂ ਕਿ ਇਹ ਕੈਬ ਦੇ ਪਿਛਲੀਆਂ ਸੀਟਾਂ ਅਤੇ ਮੂਹਰਲੀ ਸੀਟ ਜੋ ਕਿ ਮੇਰੇ ਨਾਲ ਸਵਾਰੀਆਂ ਸਨ ਇਹਨਾਂ ਨੇ ਇਹੀ ਵੀ ਦੱਸਿਆ ਹੈ ਕਿ ਗੰਦੀਆਂ ਸਨ ਅਤੇ ਉਹਨਾਂ 'ਤੇ ਗਰਦ ਅਤੇ ਧੂੜ ਜੰਮੀ ਹੋਈ ਸੀ ਅਤੇ ਵਿੱਚ ਕੁਝ ਖਾਧੀਆਂ ਪੀਤੀਆਂ ਚੀਜ਼ਾਂ ਦੇ ਕਾਗਜ਼ ਵੀ ਖਿੰਡੇ ਹੋਏ ਸਨ ਇਸ ਤੋਂ ਇਲਾਵਾ ਕੁਝ ਗੰਦੀ ਬਦਬੂਦਾਰ ਮੁਸ਼ਕ ਵੀ ਗੱਡੀ ਦੇ ਵਿੱਚੋਂ ਆ ਰਹੀ ਸੀ ਅਤੇ ਜਿਹੜਾ ਡਰਾਈਵਰ ਇਸ ਗੱਡੀ ਨੂੰ ਚਲਾ ਰਿਹਾ ਸੀ ਉਸ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ ਅਤੇ ਸੀਟਾਂ ਲਿਬੜੀਆਂ ਹੋਈਆਂ ਸਨ ਅਤੇ ਉਹ ਵਾਰ ਵਾਰ ਗੱਡੀ ਰੋਕ ਕੇ ਸਿਗਰਟ ਵੀ ਪੈਂਦਾ ਸੀ ਕਿਰਪਾ ਕਰਕੇ ਤੁਸੀਂ ਮੇਰੀ ਇਸ ਸ਼ਿਕਾਇਤ ਦੇ ਉੱਤੇ ਧਿਆਨ ਕਰਿਓ ਇਸ ਗੱਡੀ ਦਾ ਨੰਬਰ ਪੀ ਬੀ ਤੇਰ੍ਹਾਂ ਬਾਈ ਪੈਂਹਠ ਸੰਤਾਲੀ ਹੈ ਧੰਨਵਾਦ